ਭਾਰਤ ਦੇ ਵਿੱਚ ਕਾਫ਼ੀ ਸਾਰੇ ਰਾਜ ਹੈਗੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਆਪਣਾ ਆਪਣਾ ਅਲੱਗ ਤੋਂ ਸੱਭਿਆਚਾਰ ਹੈਗਾ ਹੈ ਅਤੇ ਸਭ ਦਾ ਹੀ ਜਿਹੜਾ ਸੱਭਿਆਚਾਰ ਹੈ ਬਹੁਤ ਹੀ ਵਧੀਆ ਹੈ ਅਤੇ ਸਭ ਤੋਂ ਵਿਲੱਖਣ ਹੈ ਲੇਕਿਨ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਉਹ ਵੀ ਹੋਰ ਰਾਜਾਂ ਦੇ ਜਿੰਨਾ ਹੀ ਵਿਲੱਖਣ ਅਤੇ ਬਹੁਤ ਹੀ ਸੋਹਣਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਾਰੇ ਰਾਜਾਂ ਦਾ ਜਿਹੜਾ ਸੱਭਿਆਚਾਰ ਹੈ ਉਹ ਬਹੁਤ ਹੀ ਵਧੀਆ ਅਤੇ ਅੱਛਾ ਹੈ ਅਤੇ ਸਭ ਨੂੰ ਇੱਕ ਦੂਜੇ ਦੇ ਸੱਭਿਆਚਾਰ ਦਾ ਆਦਰ ਮਾਣ ਕਰਨਾ ਚਾਹੀਦਾ ਹੈ